ਅੱਜ ਕੱਲ੍ਹ ਪੰਜਾਬੀ ਭਾਸ਼ਾ ਨੂੰ ਬਹੁਤ ਹੀ ਜ਼ਿਆਦਾ ਘੱਟ ਬੋਲਿਆ ਜਾਂਦਾ ਹੈ ਪੰਜਾਬੀ ਭਾਸ਼ਾ ਅੱਜ ਕੱਲ੍ਹ ਤੇ ਜ਼ਮਾਨੇ ਵਿੱਚ ਬਹੁਤ ਘੱਟ ਬੋਲੀ ਜਾਂਦੀ ਹੈ ਅਤੇ ਹੋਰ ਭਾਸ਼ਾਵਾਂ ਹਿੰਦੀ ਵਗੈਰਾ ਵੀ ਬਹੁਤ ਘੱਟ ਬੋਲੀ ਜਾਂਦੀ ਹੈ ਅੱਜ ਕੱਲ੍ਹ ਆਪਣੇ ਮਤਲਬ ਜੋ ਦਿਨ ਵਿੱਚ ਅਸੀਂ ਅੱਜ ਕੱਲ੍ਹ ਪੰਜਾ ਹਿੰਦੀ ਦੇ ਵਰਡ ਵੀ ਬਹੁਤ ਘੱਟ ਬੋਲਦੇ ਹਾਂ ਅਤੇ ਪੰਜਾਬੀ ਦੇ ਵਰਡ ਵੀ ਬਹੁਤ ਘੱਟ ਬੋਲਦੇ ਹਾਂ ਜ਼ਿਆਦਾ ਵਰਡ ਇੰਗਲਿਸ਼ ਦੇ ਬੋਲੇ ਜਾਂਦੇ ਹਨ ਅਤੇ ਅਸੀਂ ਹੱਦ ਤੋਂ ਵੱਧ ਸ਼ਬਦ ਇੰਗਲਿਸ਼ ਦੇ ਵਰਤਦੇ ਹਾਂ ਦਿਨ ਵਿੱਚ ਬਹੁਤ ਜ਼ਿਆਦਾ ਪੰਜਾਹ ਘੱਟੋ ਘੱਟ ਪੰਜਾਹ ਸ਼ਬਦ ਅਸੀਂ ਇੰਗਲਿਸ਼ ਦੇ ਬੋਲਦੇ ਹਾਂ ਅਤੇ ਜਿਹੜੀ ਪੰਜਾਬੀ ਭਾਸ਼ਾ ਉਹ ਪੰਜਾਬੀ ਭਾਸ਼ਾ ਅਤੇ ਸੰਸਕ੍ਰਿਤ ਭਾਸ਼ਾ ਦੇ ਕੁਝ ਵਰਡ ਸਿਮਿਲਰ ਹਨ ਅਤੇ ਕੁਝ ਦੋਵੇਂ ਕੁਝ ਦੋਵੇਂ ਭਾਸ਼ਾਵਾਂ ਦੇ ਕੁਝ ਕੁ ਵਰਡ ਇੱਕ ਦੂਜੇ ਨਾਲ ਮੇਲ ਖਾਂਦੇ ਹਨ ਅਤੇ ਅੱਜ ਕੱਲ੍ਹ ਅਸੀਂ ਅੰਗਰੇਜ਼ੀ ਭਾਸ਼ਾ ਨੂੰ ਜ਼ਿਆਦਾ ਬ ਬੜ੍ਹਾਵਾ ਦੇ ਰਹੇ ਹਾਂ ਅਤੇ ਹੱਦ ਤੋਂ ਵੱਧ ਅੰਗਰੇਜ਼ੀ ਭਾਸ਼ਾ ਨੂੰ ਆਮ ਬੋਲਿਆ ਜਾਂਦਾ ਹੈ